ਪੰਜਾਬੀ ਭਾਸ਼ਾ ਦੀ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਏ ਜਿਸ ਨੂੰ ਅਸੀਂ ਮਾਂ ਬੋਲੀ ਵੀ ਕਹਿ ਸਕਦੇ ਹਾਂ ਅਤੇ ਮਾਂ ਬੋਲੀ ਦਾ ਪਿਆਰ ਸਾਡਾ ਉਨਾਂ ਹੀ ਹੁੰਦਾ ਜਿੰਨੀ ਸਾਡੀ ਮਾਂ ਨਾਲ ਹੁੰਦਾ ਅਤੇ ਪੰਜਾਬੀ ਭਾਸ਼ਾ ਬੋਲਣ 'ਚ ਸਾਨੂੰ ਮਾਣ ਮਹਿਸੂਸ ਹੁੰਦਾ ਏ ਅਤੇ ਪੰਜਾਬੀ ਭਾਸ਼ਾ ਬਹੁਤ ਹੀ ਸੌਖੀ ਅਤੇ ਬਹੁਤ ਹੀ ਪਿਆਰੀ ਅਤੇ ਬਹੁਤ ਹੀ ਜ਼ਿਆਦਾ ਮਿੱਠੀ ਹੈ ਜਿਸ ਨਾਲ ਅਸੀਂ ਬੋਲਦੇ ਸਮੇਂ ਮਿਠਾਸ ਮੱਲੋ ਮੱਲੀ ਮੂੰਹ 'ਚੋਂ ਨਿਕਲਦੀ ਹੈ ਅਤੇ ਜੋ ਵੀ ਸਾਡੇ ਨਾਲ ਪੰਜਾਬੀ ਵਿੱਚ ਗੱਲ ਕਰਦਾ ਹੈ ਪਿਆਰ ਨਾਲ ਸਾਨੂੰ ਬਹੁਤ ਹੀ ਸਕੂਨ ਮਿਲਦਾ ਹੈ ਸਾਨੂੰ ਇਦਾਂ ਲੱਗਦਾ ਹੈ ਕਿ ਸਾਡੀ ਕੋਈ ਆਪਣਾ ਹੋਵੇ ਕਿਤੇ ਵੀ ਅਸੀਂ ਜਾਂਦੇ ਹਾਂ ਅਤੇ ਸਾਨੂੰ ਕੋਈ ਵੀ ਪੰਜਾਬੀ 'ਚ ਗੱਲ ਕਰਦਾ ਤਾਂ ਸਾਨੂੰ ਆਪਣਾ ਲੱਗਦਾ ਹੈ ਅਤੇ ਪੰਜਾਬੀ ਭਾਸ਼ਾ ਬਹੁਤ ਹੀ ਸਰਲ ਸ਼ੁੱਧ ਅਤੇ ਸਪੱਸ਼ਟ ਹੈ ਅਤੇ ਇਸ ਦੇ ਗੁਣ ਅਸੀਂ ਜੇ ਜਾਣਨੇ ਹੋਣ ਤਾਂ ਇਹ ਵੇਦ ਪੁਰਾਣ ਅਤੇ ਗ੍ਰੰਥ ਵੀ ਸਾਡੇ ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤ ਵਿੱਚ ਹੀ ਲਿਖੇ ਗਏ ਹਨ ਅਤੇ ਪੰਜਾਬੀ ਭਾਸ਼ਾ ਨਾਲ ਅਸੀਂ ਹਮੇਸ਼ਾਂ ਜੁੜੇ ਰਹਾਂਗੇ ਪੰਜਾਬੀ ਭਾਸ਼ਾ 'ਤੇ ਸਾਨੂੰ ਮਾਣ ਹੈ